ਲਵਲੀ ਰੈਸੋਡੈਂਟ ਜੀ ਹਾਂ ਸਾਡੇ ਘਰ ਵਿੱਚ ਇੱਕ ਛੋਟਾ ਜਿਹਾ ਫੰਕਸ਼ਨ ਹੈ ਅਸੀਂ ਤੁਹਾਡੇ ਕੋਲੋਂ ਭੋਜਨ ਦਾ ਔਡਰ ਕਰਵਾਇਆ ਸੀ ਅਸੀਂ ਪਹਿਲਾਂ ਵੀ ਤੁਹਾਡੇ ਕੋਲੋਂ ਕਈ ਵਾਰ ਔਡਰ ਕਰਵਾ ਚੁੱਕੇ ਹਾਂ ਤੁਹਾਡਾ ਡਿਲੀਵਰੀ ਸਾਡੇ ਘਰ ਵਿੱਚ ਖਾਣਾ ਦੇ ਗਿਆ ਘੰਟੇ ਬਾਅਦ ਸਾਡੇ ਰਿਸ਼ਤੇਦਾਰ ਕੁਝ ਖਾਣਾ ਖਾਣ ਲੱਗੇ ਤਾਂ ਕਹਿਣ ਲੱਗੇ ਸਾਡੇ ਦਿਲ ਨੂੰ ਕੁਝ ਹੁੰਦਾ ਹੈ ਅਸੀਂ ਜਦੋਂ ਖਾਣਾ ਚੈੱਕ ਕੀਤਾ ਤਾਂ ਤੁਹਾਡੇ ਖਾਣੇ ਵਿੱਚ ਖਰਾਬੀ ਸੀ ਸੜਿਆ ਅਤੇ ਬਾਸੇ ਹੋਣ ਦੀ ਵਾਸ਼ਨਾ ਆਉਂਦੀ ਸੀ ਇਸ ਲਈ ਅਸੀਂ ਜਦੋਂ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਕਿਹਾ ਤੁਸੀਂ ਕੀ ਖਾਧਾ ਹੈ ਅਸੀਂ ਕਿਹਾ ਇਹਨਾਂ ਖਾਣਾ ਖਾਂਦਾ ਹੈ ਉਹਨਾਂ ਕਿਹਾ ਤੁਸੀਂ ਖਾਣਾ ਨਾ ਖਾਓ ਖਾਣੇ ਵਿੱਚ ਖਰਾਬੀ ਹੈ ਇਸ ਲੀਏ ਅਸੀਂ ਇਹ ਖਾਣੇ ਨੂੰ ਤੁਹਾਡੇ ਕੋਲ ਵਾਪਸ ਭੇਜ ਰਹੇ ਹਾਂ ਤੁਸੀਂ ਆਪਣਾ ਖਾਣਾ ਵਾਪਿਸ ਲੈ ਜਾਓ ਅਤੇ ਸਾਡੇ ਪੈਸੇ ਸਾਨੂੰ ਵਾਪਿਸ ਦੇ ਦਿਓ ਕਿਉਂਕਿ ਇਹ ਖਾਣਾ ਖਾ ਕੇ ਅਸੀਂ ਬਿਮਾਰ ਹੋ ਸਕਦੇ ਹਾਂ ਪਰ ਹੁਣ ਅਸੀਂ ਇਹ ਖਾਣਾ ਨਹੀਂ ਖਾਵਾਂਗੇ ਤੁਸੀਂ ਪਲੀਜ਼ ਇਹ ਖਾਣਾ ਵਾਪਿਸ ਲੈ ਜਾਓ ਅਤੇ ਸਾਡੇ ਪੈਸੇ ਸਾਨੂੰ ਵਾਪਿਸ ਦੇ ਦਿਓ